ਜਿਵੇਂ ਕਿ ਮੈਂ ਇੱਕ ਡਿਵੈਲਪ ਅਤੇ ਬਹੁਤ ਵਧੀਆ ਸ਼ਹਿਰ ਦੇ ਵਿੱਚ ਰਹਿੰਦੀ ਹਾਂ ਇੱਥੇ ਪਾਣੀ ਦੀ ਸਪਲਾਈ ਬਹੁਤ ਵਧੀਆ ਅਤੇ ਹਰ ਘਰ ਹਰ ਦੁਕਾਨ ਅਤੇ ਹਰ ਜਗ੍ਹਾ ਦੇ ਵਿੱਚ ਬਹੁਤ ਟਾਈਮ 'ਤੇ ਅਤੇ ਜਲਦੀ ਮਿਲ ਜਾਂਦੀ ਹੈ ਜਿਵੇਂ ਕਿ ਮੇਰੇ ਘਰ ਦੇ ਵਿੱਚ ਬਹੁਤ ਸਾਰੀਆਂ ਟੂਟੀਆਂ ਲੱਗੀਆਂ ਹਨ ਜਿੱਥੇ ਅਸੀਂ ਕਦੇ ਆਪਣੇ ਭਾਂਡੇ ਧੋਂਦੇ ਹਾਂ ਕਦੇ ਕੱਪੜੇ ਧੋਂਦੇ ਹਾਂ ਅਤੇ ਕਦੇ ਨਹਾਉਂਦੇ ਹਾਂ ਇਸ ਨਾਲ ਮੇਰਾ ਜੀਵਨ ਇੱਦਾਂ ਵੱਖਰਾ ਹੈ ਕਿ ਮੈਂ ਆਪਣੇ ਆਪ ਨੂੰ ਸਾਫ ਸੁਥਰਾ ਰੱਖਦੀ ਹਾਂ ਆਪਣੇ ਖਾਣ ਵਾਲੇ ਬਰਤਨਾਂ ਨੂੰ ਸਾਫ ਸੁਥਰਾ ਰੱਖਦੀ ਹਾਂ ਅਤੇ ਆਪਣੇ ਪਹਿਨਣ ਵਾਲੇ ਕੱਪੜਿਆਂ ਨੂੰ ਪਾਣੀ ਦੀ ਵਰਤੋਂ ਦੇ ਨਾਲ ਅਸੀਂ ਆਪਣਾ ਵਾਤਾਵਰਨ ਸਾਫ ਰੱਖ ਸਕਦੇ ਹਾਂ ਅਤੇ ਜਿਵੇਂ ਕਿ ਮੈਂ ਦੱਸਿਆ ਹੀ ਸੀ ਕਿ ਅਸੀਂ ਬਹੁਤ ਹੀ ਡਿਵੈਲਪ ਸ਼ਹਿਰ ਦੇ ਵਿੱਚ ਰਹਿੰਦੇ ਹਾਂ ਤਾਂ ਇੱਥੇ ਸਾਡੇ ਕੋਲ ਪੰਪ ਅਤੇ ਮੋਟਰ ਵਰਗੀਆਂ ਸੁਵਿਧਾ ਬਹੁਤ ਹੀ ਵਧੀਆ ਤੌਰ 'ਤੇ ਸਾਨੂੰ ਮਿਲਦੀਆਂ ਹਨ ਜਿਹਨਾਂ ਦੇ ਥਰੂ ਸਾਨੂੰ ਇੱਕ ਸਾਫ ਪਾਣੀ ਪ੍ਰਦਾਨ ਹੁੰਦਾ ਹੈ